ਮੇਰੇ ਪਰਿਵਾਰ ਦੇ ਵਿੱਚ ਮੇਰੇ ਮਦਰ ਫਾਦਰ ਤਿੰਨ ਸਿਸਟਰ ਅਤੇ ਇੱਕ ਬ੍ਰਦਰ ਹੈ ਮੇਰੇ ਮੈਂ ਆਪਣੀ ਭੈਣਾਂ ਨਾਲ ਬਹੁਤ ਲਗਾਅ ਕਰਦੀ ਹਾਂ ਕਿਉਂਕਿ ਮੇਰੀ ਹਰ ਗੱਲ ਸਮਝਦੀਆਂ ਨੇ ਅਤੇ ਮੇਰੇ ਮਦਰ ਫਾਦਰ ਵੀ ਬਹੁਤ ਮਿਹਨਤੀ ਨੇ ਅਤੇ ਮੇਰੇ ਪਾਪਾ ਕਾਰ ਡਰਾਈਵਰ ਨੇ ਉਹ ਸਕੂਲ ਦੀ ਬੱਸ ਚਲਾਉਂਦੇ ਨੇ ਅਤੇ ਮੰਮਾ ਮੰਮਾ ਬਾਹਰ ਜਾ ਕੇ ਕੋਠੀਆਂ 'ਚ ਕੰਮ ਕਰਦੇ ਨੇ ਜਿਵੇਂ ਕਿ ਸ਼ਾਮ ਦੀ ਕੁਕਿੰਗ ਵਗੈਰਾ ਕਰਦੇ ਨੇ ਅਤੇ ਮੇਰੇ ਚਾਚਾ ਜੀ ਵੀ ਸਾਡੇ ਨਾਲ ਹੀ ਰਹਿੰਦੇ ਨੇ ਅਤੇ ਉਹ ਪੁਲਿਸ ਪੁਲਿਸ ਔਫਿਸਰ ਨੇ ਅਤੇ ਉਹਨਾਂ ਦੀ ਵਾਈਫ ਘਰਾਂ ਵਿੱਚ ਜਾ ਕੇ ਕੰਮ ਕਰਦੀ ਹੈ ਮੇਰੀਆਂ ਭੈਣਾਂ ਸਾਰੀਆਂ ਹੀ ਪੜ੍ਹੀਆਂ ਲਿਖੀਆਂ ਹਨ ਮੇਰਾ ਭਰਾ ਵੀ ਪੜ੍ਹਿਆ ਲਿਖਿਆ ਹੈ ਮੇਰੇ ਭਰਾ ਪਲੱਸ ਵੰਨ 'ਚ ਹੈ ਅਤੇ ਛੋਟੀ ਸਭ ਤੋਂ ਪਲੱਸ ਟੂ 'ਚ ਹੈ ਅਤੇ ਸਾਡੀ ਕੋਈ ਜੁਆਇੰਟ ਫੈਮਿਲੀ ਨਹੀਂ ਹੈ ਕਿਉਂਕਿ ਬਾਕੀ ਸਾਰਾ ਪਰਿਵਾਰ ਪਿੰਡ ਰਹਿੰਦਾ ਹੈ ਭੈਣਾਂ ਬਹੁਤ ਹੀ ਚੰਗੀਆਂ ਨੇ ਇੱਕ ਭੈਣ ਦੀ ਮੈਰਿਜ ਹੋ ਚੁੱਕੀ ਹੈ ਅਤੇ ਉਸ ਦੇ ਦੋ ਬੱਚੇ ਹਨ ਮੇਰੇ ਜੀਜਾ ਜੀ ਦਾ ਨੇਚਰ ਵੀ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਅਤੇ ਉਹ ਉਹ ਵੀ ਹਰ ਗੱਲ ਸਮਝਦੇ ਨੇ ਅਤੇ ਸਾਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦੇ ਨੇ ਮੇਰੇ ਮੇਰੇ ਦਾਦੀ ਜੀ ਵੀ ਬਜ਼ੁਰਗ ਨੇ ਉਹ ਵੀ ਉਹ ਘਰ ਵਿੱਚ ਹੀ ਰਹਿੰਦੇ ਨੇ ਅਤੇ ਉਹ ਘਰਦਾ ਹੀ ਕੰਮ ਕਰਦੇ ਨੇ ਅਤੇ ਮੇਰੇ ਦਾਦਕੇ ਵੀ ਬਹੁਤ ਚੰਗੇ ਹਨ ਬਹੁਤ ਚੰਗੇ ਹਨ ਕਿਉਂਕਿ ਉਹ ਸਾਡੀ ਹਰ ਗੱਲ ਨੂੰ ਸਮਝਦੇ ਅਤੇ ਗੱਲਬਾਤ ਕਰਨ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਕਰਦੇ ਨੇ